ਸਕੂਲਾਂ ਵਿੱਚ ਅਧਿਆਪਕਾਂ ਨੂੰ ਪੜ੍ਹਾਉਣ ਲਈ ਬਹੁਤ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਸਭ ਤੋਂ ਮੇਜਰ ਜਿਹੜੀ ਚੀਜ਼ ਬਲੈਕਬੋਰਡ ਚੋਕ ਹੋ ਗਿਆ ਲੈਟਿੰਗ ਦਾ ਪੂਰਾ ਪ੍ਰਬੰਧ ਹੋਵੇ ਇਹ ਤਾਂ ਬੇਸਿਕ ਜਮ੍ਹਾਂ ਹੀ ਮਤਲਬ ਜਿਸ ਬਿਨਾਂ ਨਾ ਸਰਨਾ ਨੀਗਾ ਆਪਣਾ ਜਮ੍ਹਾਂ ਹੀ ਹਵਾ ਦਾ ਸਹੀ ਪ੍ਰਬੰਧ ਹੋਵੇ ਆਸ ਪਾਸ ਦਾ ਮਾਹੌਲ ਵਧੀਆ ਹੋਵੇ ਕੋਈ ਇਹੋ ਜਿਹੀ ਥਾਂ ਨਾ ਹੋਵੇ ਪੱਬ ਨੇੜੇ ਜਾਂ ਕਿਤੇ ਬੱਸ ਸਟੈਂਡ ਇਹੋ ਜਿਹੀ ਜਗ੍ਹਾ ਜਿੱਥੇ ਬਹੁਤ ਗਾਹ ਹੋਵੇ ਉੱਥੇ ਨਾ ਹੋਵੇ ਕਿਉਂਕਿ ਬੱਚੇ ਨੂੰ ਅਗਲਾ ਪੜ੍ਹਾਵੇਗਾ ਵੀ ਕੀ ਜੇ ਜਿਹੜਾ ਮਾਹੌਲ ਆ ਸ਼ਾਂਤੀ ਪਿਆ ਹੋਵੇ ਢੁਕਵਾਂ ਜਿਹਾ ਹੋਵੇ ਬੱਚੇ ਨੂੰ ਪੜ੍ਹਾਵੇ ਅਗਲਾ ਤਾਂ ਹੀ ਵੀ ਬੱਚੇ ਨੂੰ ਵੀ ਚੰਗੀ ਤਰ੍ਹਾਂ ਸਮਝ ਆ ਰੱਖੇ ਤਾਂ ਸਾਧਨ ਇਹ ਪੂਰੇ ਹੋਣੇ ਚਾਹੀਦੇ ਨੇ ਲੈਟਾਂ ਵਧੀਆ ਹ ਹਵਾ ਦਾ ਪ੍ਰਬੰਧ ਹੋਵੇ ਕੋਈ ਇਹੋ ਜਿਹੀ ਥਾਂ ਨਾ ਹੋਵੇ ਜਿੱਥੇੇ ਕਿ ਸਾਊਂਡ ਬਹੁਤ ਜ਼ਿਆਦਾ ਹੋਵੇ ਅਤੇ ਜਿਹੜੀ ਸਕੂਲਾਂ ਵਿੱਚ ਕਮੀਆਂ ਨੇ ਉਹ ਕਮੀਆਂ ਇਹ ਨੇ ਪਹਿਲਾਂ ਤਾਂ ਸਕੂਲਾਂ ਵਿੱਚ ਟੀਚਰ ਹੀ ਨਹੀਂ ਪੂਰੇ ਇੱਕ ਐਡੇ ਐਡੇ ਸਕੂਲ ਹੁੰਦੇ ਆ ਉਹਨਾਂ 'ਚ ਬੇਚਾਰੇ ਇੱਕ ਇੱਕ ਟੀਚਰ ਸਾਂਭ ਰਿਹਾ ਹੁੰਦਾ ਉਹ ਸਾਭਿਆਂ ਵੀ ਵੀ ਐਨੇ ਔਖੇ ਹੋ ਰੱਖੇ ਹੁੰਦੇ ਆ ਬੇਚਾਰੇ ਆਪ ਵੀ ਫਰੱਸਟਰੇਟ ਹੋ ਜਾਂਦੇ ਨੇ ਤਾਂ ਟੀਚਰਾਂ ਦੀ ਭਰਤੀ ਵੀ ਬਹੁਤ ਜ਼ਰੂਰੀ ਆ ਅਤੇ ਉਸ ਤੋਂ ਬਾਅਦ ਕਿ ਬੱਚਿਆਂ ਲਈ ਵੀ ਇੰਨੀਆਂ ਕਮੀਆਂ ਹੁੰਦੀਆਂ ਬੈਠਣ ਨੂੰ ਟਾਟਾਂ 'ਤੇ ਬਿਠਾ ਦਿੰਦੇ ਨੇ ਠੰਡ 'ਚ ਉਹਨਾਂ ਨੂੰ ਠੰਡ ਲੱਗੀ ਜਾਂਦੀ ਕੀ ਬੱਚੇ ਦਾ ਧਿਆਨ ਪੜ੍ਹਾਈ 'ਚ ਜਾਊਗਾ ਬੈਠਣ ਲਈ ਸਹੀ ਪਲੇਸ ਹੋਵੇ ਖਿੜਕੀਆਂ ਹੋਣ ਬੰਦ ਹੋਣ ਵਾਲੀਆਂ ਟੁੱਟੀਆਂ ਵੀਆਂ ਖਿੜਕੀਆਂ ਨਾ ਹੋਣ ਲਾਈਟਾਂ ਦਾ ਸਹੀ ਪ੍ਰਬੰਧ ਹੋਵੇ ਸਮਾਰਟ ਬੋਰਡ ਲੱਗੇ ਹੋਣ ਬੱਚੇ ਨੂੰ ਪੜ੍ਹਾਉਣ ਪੜ੍ਹਨ ਆਉ ਅਤੇ ਸਮਝ ਆਵੇ ਡੀਪਲੀ ਉਹ ਚੀਜ਼ਾਂ 'ਚ ਬੱਚੇ ਜਾ ਸਕਣ ਟੀਚਰ ਨੂੰ ਪੜ੍ਹਾਉਣ 'ਚ ਵੀ ਫੇਰ ਮਜ਼ਾ ਆਵੇ ਬੱਚੇ ਨੂੰ ਪੜ੍ਹਨ 'ਚ ਵੀ ਸਮਝ ਆਵੇ ਮਜ਼ਾ ਆਵੇ ਪੜ੍ਹਾਈ ਇੰਜੋਆਏਮੈਂਟ ਦੀ ਤਰ੍ਹਾਂ ਹੋਜੇ ਕਈ ਚੀਜ਼ਾਂ ਨੇ ਜਿਹੜੀਆਂ ਧਿਆਨ ਕਰਨਾ ਚਾਹੀਦਾ ਸੀਵਰ ਬਲੋਕ ਹੋ ਜਾਂਦੇ ਸਕੂਲਾਂ 'ਚ ਪਾਣੀ ਭਰ ਜਾਂਦਾ ਹੁੰਦਾ ਸੈਨੇਟਰੀ ਪੈਡ ਦੀ ਕੋਈ ਉਹ ਨਹੀਂ ਹੁੰਦੀ ਸੁਵਿਧਾ ਮੀਹਾਂ ਦਾ ਪਾਣੀ ਸਿਰ 'ਤੇ ਪਈ ਜਾਂਦਾ ਬੱਚੇ ਥੱਲੇ ਬੈਠੇ ਰਹਿੰਦੇ ਨੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਹੀ ਆਪਣਾ ਐਜੂਕੇਸ਼ਨ ਸਿਸਟਮ ਅੱਗੇ ਵਧੇਗਾ ਇਹ ਚੀਜ਼ਾਂ ਵੱਲ ਗੌਰ ਕੀਤੀ ਜਾਵੇ